ਮੋਹਾਲੀ ਜ਼ਿਲ੍ਹੇ ਵਿੱਚ ਮੁੱਖ ਖੇਤੀਬਾੜੀ ਉਤਪਾਦ ਹਨ ਉਹ ਕਣਕ ਚਾਵਲ ਝੋਨਾ ਜਿਹਨੂੰ ਕਹਿੰਦੇ ਹੈ ਅਤੇ ਗੰਨਾ ਅਤੇ ਹੋਰ ਫਸਲਾਂ ਜਿਹੜੀਆਂ ਉਹਨਾਂ ਦਾ ਉਤਪਾਦ ਹੁੰਦਾ ਹੈ ਜੋ ਖੇਤੀ ਅਭਿਆਸ ਹਨ ਉਸਦੇ ਵਿੱਚ ਕਿਸਾਨ ਵਧੀਆ ਤਰੀਕੇ ਨਾਲ ਖੇਤੀ ਕਰਦੇ ਹਨ ਫਸਲਾਂ ਜਿਹੜੀਆਂ ਉਹਨਾਂ ਨੂੰ ਕੀਟਾਣੂ ਰਹਿਤ ਕਰਨ ਲਈ ਯੂਨੀਵਰਸਿਟੀਜ ਜਿਹੜੀ ਖੋਲ੍ਹੀਆਂ ਹੋਈਆਂ ਹਨ ਸਰਕਾਰ ਵੱਲੋਂ ਪਸ਼ੂ ਧੰਦੇ ਵਿੱਚ ਜੋ ਬਲ਼ਦ ਹਨ ਜਾਂ ਅੱਜ ਦੀ ਨਵੀ ਟੈਕਨੋਲਜੀ ਜਿਹੜਾ ਟਰੈਕਟਰ ਵਗੈਰਾ ਦੇ ਨਾਲ ਖੇਤੀ ਜਿਹੜੀ ਹੁੰਦੀ ਹੈਗੀ ਹੈ ਸਰਕਾਰ ਵੱਲੋਂ ਸਿੰਚਾਈ ਦੇ ਸਾਧਨ ਉਪਲਬਧ ਕਰਵਾਏ ਗਏ ਹਨ ਜਿਹਦੇ ਵਿੱਚ ਟਿਊਬਵੈੱਲ ਅਤੇ ਹੋਰ ਸਿੰਚਾਈ ਅੰਤਰ ਸ਼ਾਮਿਲ ਹਨ ਟੈਕਨੋਲਜੀ ਖੇਤੀਬਾੜੀ ਦੇ ਵਿੱਚ ਪ੍ਰਯੋਗ ਕੀਤੀ ਜਾ ਰਹੀ ਹੈ ਜੋ ਕਿ ਸਰਕਾਰ ਵੱਲੋਂ ਸਮੇਂ ਸਮੇਂ 'ਤੇ ਕਿਸਾਨਾਂ ਨੂੰ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ